ਤਕਨਾਲੋਜੀ ਵਿੱਚ ਹੋਣ ਵਾਲੀ ਰੋਜ਼ ਦਿਨ ਮੱਰਾ ਦੀ ਜ਼ਿੰਦਗੀ ਦੇ ਵਿੱਚ ਹੋਣ ਵਾਲੀ ਤਰੱਕੀ ਨੇ ਸਾਡੇ ਜ਼ਿੰਦਗੀ ਨੂੰ ਬਦਲ ਰੱਖ ਕੇ ਰੱਖਤਾ ਕਿਵੇਂ ਹੁਣ ਸਾਡੇ ਸਾਰਿਆਂ ਦੇ ਕੋਲ ਸਮਾਰਟਫੋਨ ਨੇ ਇੱਕ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਚਾਰ ਮੈਂਬਰ ਨੇ ਤਾਂ ਚਾਰ ਸਮਾਰਟਫੋਨ ਚੱਲ ਰਹੇ ਨੇ ਪੰਜ ਮੈਂਬਰ ਨੇ ਤਾਂ ਪੰਜ ਸਮਾਰਟਫੋਨ ਚਲਦੇ ਪਏ ਨੇ ਸਮਾਰਟਫੋਨ ਦੇ ਨਾਲ ਫਾਇਦਾ ਵੀ ਹੋਇਆ ਅਤੇ ਨੁਕਸਾਨ ਵੀ ਹੋਇਆ ਕਿ ਸਾਡੀ ਸਾਡੀਆਂ ਘੜੀਆਂ ਖੋਹੀਆਂ ਗਈਆਂ ਸਾਡਾ ਸਮਾਂ ਜਿਹੜਾ ਸਾਰਾ ਅਸੀਂ ਫੋਨ 'ਤੇ ਹੀ ਅਗਰ ਵਿਹਲੇ ਹਾਂ ਤਾਂ ਫੋਨ 'ਤੇ ਹੀ ਲਗਾ ਦਿੰਦੇ ਹਾਂ ਇਹਦੇ ਨਾਲ ਵਧੀਆ ਵੀ ਹੋਇਆ ਹੈ ਕਈ ਵਾਰੀ ਕਿਸੇ ਜਗ੍ਹਾ 'ਤੇ ਪਹੁੰਚੇ ਹੁੰਦੇ ਹਾਂ ਕਿਤੇ ਦੂਰ ਹੋਈ ਦਾ ਤਾਂ ਘਰ ਦੱਸਣਾ ਬੜਾ ਸੌਖਾ ਹੋ ਜਾਂਦਾ ਪਤਾ ਲੱਗ ਜਾਂਦਾ ਕਿ ਇਨਸਾਨ ਠੀਕ ਠਾਕ ਹੈ ਕਿੱਥੇ ਹੈ ਇੰਟਰਨੈਟ ਦੇ ਨਾਲ ਹੁਣ ਸਾਡੇ ਕਈ ਵਾਰੀ ਬੱਚੇ ਬਾਹਰ ਹੁੰਦੇ ਨੇ ਜਾਂ ਅਸੀਂ ਆਪਣੇ ਮਾਤਾ ਪਿਤਾ ਦੂਰ ਹੋਈ ਦਾ ਬਾਹਰ ਹੋਈ ਦਾ ਤਾਂ ਗੱਲ ਕਰਨੀ ਬੜੀ ਸੌਖੀ ਹੋ ਗਈ ਹੈ ਇੰਟਰਨੈਟ ਦੇ ਥਰੂ ਅਸੀਂ ਉਹਨਾਂ ਦੀਆਂ ਸ਼ਕਲਾਂ ਵੀ ਵੇਖ ਸਕਦੇ ਹਾਂ ਗੱਲ ਕਰ ਸਕਦੇ ਹਾਂ ਇੰਟਰਨੈਟ 'ਤੇ ਅਸੀਂ ਕੋਈ ਵੀ ਚੀਜ਼ ਦੀ ਖੋਜ ਕਰ ਸਕਦੇ ਹਾਂ ਪਤਾ ਕਰ ਸਕਦੇ ਹਾਂ ਕਿੱਥੇ ਕੀ ਚੱਲ ਰਿਹਾ ਕਿ ਜਿਹੜੀਆਂ ਚੀਜ਼ਾਂ ਕਿਹੜੇ ਰੇਟ 'ਤੇ ਮਿਲ ਰਹੀਆਂ ਨੇ ਕਿੱਥੇ ਕੀ ਹੋ ਰਿਹਾ ਦੁਨੀਆ ਦੀ ਖਬਰ ਸਾਰੀ ਦੁਨੀਆ ਦੀ ਖਬਰ ਅਸੀਂ ਇੱਕ ਮਿੰਟ ਦੇ ਵਿੱਚ ਜਿਹੜੇ ਆਪਣੇ ਫੋਨ ਦੇ ਵਿੱਚ ਹੀ ਲੈ ਸਕਦੇ ਹਾਂ ਫੇਰ ਹੁਣ ਟਿਕਟ ਬੁੱਕ ਕਰਵਾਉਣੀ ਹੁੰਦੀ ਸੀ ਪਹਿਲਾਂ ਸਾਨੂੰ ਰੇਲਵੇ ਸਟੇਸ਼ਨ 'ਤੇ ਜਾਣਾ ਪੈਂਦਾ ਜੇ ਅਸੀਂ ਜਹਾਜ਼ ਦੀ ਬੁੱਕ ਕਰਵਾਉਣੀ ਹੈ ਤਾਂ ਸਾਨੂੰ ਹਵਾਈ ਅੱਡੇ ਜਾਣਾ ਪੈਂਦਾ ਸੀ ਪਰ ਨਹੀਂ ਹੁਣ ਜਿਹੜਾ ਹੈ ਅਸੀਂ ਇੰਟਰਨੈੱਟ ਦੇ ਥਰੂ ਅਸੀਂ ਆਪਣੇ ਫੋਨ ਤੋਂ ਹੀ ਬੜੀ ਜਲਦੀ ਟਿਕਟ ਆਉਣੀ ਹੈ ਨਾ ਬੁੱਕ ਕਰਵਾ ਸਕਦੇ ਹਾਂ ਕੋਈ ਹੋਟਲ ਬੁੱਕ ਕਰਨਾ ਅਸੀਂ ਕਿਤੇ ਘੁੰਮਣ ਜਾ ਰਹੇ ਹਾਂ ਦੂਰ ਪਹਿਲਾਂ ਉੱਥੇ ਜਾ ਕੇ ਹੋਟਲ ਵੇ ਦੇਖ ਕੇ ਹੀ ਬੁੱਕ ਕੀਤਾ ਜਾਂਦਾ ਸੀ ਪਰ ਹੁਣ ਅਗਰ ਅਸੀਂ ਲੇਟ ਵੀ ਹੋ ਰਹੇ ਹਾਂ ਤਾਂ ਅਸੀਂ ਪਹਿਲਾਂ ਹੀ ਬੁੱਕ ਕਰਵਾ ਦਾਂਗੇ ਤਾਂ ਸਾਨੂੰ ਉੱਥੇ ਜਾ ਕੇ ਰਹਿਣਾ ਬਹੁਤ ਸੌਖਾ ਹੋ ਜੇਗਾ ਕਈ ਵਾਰੀ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਮੰਨ ਲਓ ਕੋਈ ਐਤਵਾਰ ਦਾ ਦਿਨ ਹੀ ਹੈ ਉਹ ਦਿਨ ਅਸੀਂ ਨਹੀਂ ਦੇ ਪਾ ਰਹੇ ਬੈਂਕ ਨਹੀਂ ਚੱਲ ਰਹੇ ਤਾਂ ਉਸ ਦਿਨ ਅਸੀਂ ਜਿਹੜਾ ਹੈ ਨੈੱਟ ਦੇ ਥਰੂ ਹੁਣ ਗੂਗਲ ਪੇ ਵਰਤਣ ਲੱਗ ਗਏ ਪੇਟੀਐਮ ਕਰਨ ਲੱਗ ਗਏ ਇੱਕ ਮਿੰਟ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਹੀ ਤੁਸੀਂ ਜਿੱਥੇ ਮਰਜ਼ੀ ਪੈਸਾ ਜਿਹੜਾ ਆਪਣਾ ਭੇਜ ਸਕਦੇ ਹੋ ਜਾਂ ਮੰਗਵਾ ਵੀ ਸਕਦੇ ਹੋ ਕਿਸੇ ਨੂੰ ਅੱਜ ਕੱਲ ਜੇਬ ਦੇ ਵਿੱਚ ਵੀ ਪੈ ਅਗਰ ਪੈਸੇ ਨਹੀਂ ਰੱਖੇ ਹੋਏ ਉਹਦੇ ਕੋਲ ਫੋਨ ਹੈ ਤਾਂ ਜਾ ਕੇ ਉੱਥੇ ਕਿਸੇ ਦੁਕਾਨਦਾਰ ਤੋਂ ਕੋਈ ਸਮਾਨ ਖਰੀਦਿਆ ਨਾਲ ਦੀ ਨਾਲ ਉਹਨੂੰ ਗੂਗਲ ਪੇ ਕਰ ਸਕਦਾ ਹੈ ਅਤੇ ਸਕੈਨਰ ਲੱਗੇ ਹੋਏ ਨੇ ਸਕੈਨਰ ਦੇ ਉੱਪਰ ਜਾਓ ਅਤੇ ਉੱਥੇ ਸਰਚ ਆਪਣੇ ਕੋਲ ਤੁਹਾਡੇ ਗੂਗਲ ਪੇ ਦੇ ਵਿੱਚ ਪੈਸੇ ਹੋਣ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਹੋਣੇ ਚਾਹੀਦੇ ਨੇ ਤੁਸੀਂ ਕਿਸੇ ਨੂੰ ਵੀ ਕਿਸੇ ਵੀ ਟਾਈਮ 'ਤੇ ਤੁਸੀਂ ਖਰੀਦਦਾਰੀ ਜਿਹੜੀ ਹੈ ਉਹ ਕਰ ਸਕਦੇ ਹੋ ਚੀਜ਼ਾਂ ਜਿਹੜੀਆਂ ਨੇ ਹੁਣ ਅਸੀਂ ਔਨਲਾਈਨ ਮੰਗਵਾ ਲੈਂਦੇ ਹਾਂ ਇੰਟਰਨੈਟ ਦੇ ਕਰਕੇ ਹੀ ਮੰਗਵਾ ਲੈਂਦੇ ਹਾਂ ਇੰਟਰਨੈਟ ਚਲਦਾ ਫੋਨ ਚਲਦੇ ਨੇ ਅਤੇ ਅਸੀਂ ਕੋਈ ਚੀਜ਼ ਜਿਹੜੀ ਕਿਸੇ ਹੋਰ ਵੀ ਆ ਬਹੁਤ ਦੂਰ ਆ ਉਹ ਕਿਤੇ ਹੋਰ ਦੂਰ ਭੇਜਣੀ ਹੋਵੇ ਜਾਂ ਮੰਗਵਾਉਣੀ ਹੋਵੇ ਬੜੀ ਜਲਦੀ ਮੰਗਵਾ ਸਕਦੇ ਹਾਂ ਬੜੀਆਂ ਚੀਜ਼ਾਂ ਬਾਰੇ ਸਾਨੂੰ ਜਿਹੜੀ ਜਾਣਕਾਰੀ ਆ ਮਿਲਦੀ ਆ ਅਤੇ ਇਹਦੇ ਨਾਲ ਨੁਕਸਾਨ ਵੀ ਹੋਇਆ ਨੁਕਸਾਨ ਦੇ ਨਾਲ ਜ਼ਿੰਦਗੀ ਬਦਲੀ ਹੈ ਨੁਕਸਾਨ ਹੋਇਆ ਕਿ ਹੁਣ ਅਸੀਂ ਆਪਣੇ ਪਰਿਵਾਰ ਦੇ ਵਿੱਚ ਇਕੱਠੇ ਮਿਲ ਕੇ ਨਹੀਂ ਬਹਿੰਦੇ ਸਾਰੇ ਬੱਚੇ ਮੈਂਬਰ ਜਿੰਨੇ ਵੀ ਹੈਗੇ ਆ ਘਰ ਦੇ ਵਿੱਚ ਹਰੇਕ ਕੋਲ ਆਪਣਾ ਆਪਣਾ ਫੋਨ ਹੈ ਆਪਣਾ ਆਪਣਾ ਫੋਨ ਖੋਲ੍ਹ ਕੇ ਰੱਖਦਾ ਆਪਣੇ ਆਪਣੇ ਫੋਨ 'ਤੇ ਹੀ ਦੇਖੀ ਜਾਂਦਾ ਕੋਈ ਕਿਸੇ ਨਾਲ ਗੱਲ ਕਰਕੇ ਖੁਸ਼ ਹੀ ਨਹੀਂ ਹੈ ਕਿਸੇ ਕੋਲ ਸਮ ਸਮਾਂ ਹੀ ਨਹੀਂ ਹੈ ਕਿ ਉਹ ਦੂਸਰੇ ਨਾਲ ਗੱਲ ਕਰ ਸਕੇ ਹੁਣ ਜਿਹੜੇ ਦੂਰ ਬੈਠੇ ਨੇ ਉਹ ਨੇੜੇ ਹੋ ਗਏ ਅਤੇ ਜਿਹੜੇ ਸਾਡੇ ਨੇੜੇ ਬੈਠੇ ਨੇ ਉਹ ਦੂਰ ਹੋ ਗਏ ਦੂਰ ਬੈਠੇ ਨੇੜੇ ਕਿਵੇਂ ਹੋ ਗਏ ਫੋਨ 'ਤੇ ਅਸੀਂ ਉਹਨਾਂ ਦੇ ਨਾਲ ਮੈਸੇਜ ਕਰਦੇ ਹਾਂ ਉਹਨਾਂ ਦੀਆਂ ਫੇਸਬੁਕ 'ਤੇ ਉਹਨਾਂ ਦੇ ਇੰਸਟਾਗਰਾਮ ਅਕਾਊਂਟ 'ਤੇ ਉਹਦੇ ਨਾਲ ਜੁੜੇ ਹੋਏ ਹਾਂ ਪਰ ਜਿਨ੍ਹਾਂ ਨੇ ਸਾਡੀ ਮੁਸੀਬਤ ਰਾਹੀਂ ਸਾਡੇ ਨਾਲ ਖੜ੍ਹਨਾ ਸਾਡੇ ਘਰ ਦੇ ਮੈਂਬਰ ਉਹ ਸਾਡੇ ਤੋਂ ਦੂਰ ਨੇ ਉਹਨਾਂ ਕੋਲ ਸਾਡੇ ਲਈ ਸਮਾਂ ਹੀ ਨਹੀਂ ਹੈ ਅਤੇ ਸਾਡੇ ਕੋਲ ਉਹਨਾਂ ਲਈ ਸਮਾਂ ਹੀ ਨਹੀਂ ਹੈ ਕਿ ਅਸੀਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕਰ ਸਕੀਏ